ਖੇਡਾਂ ਹਰ ਇੱਕ ਦੇ ਜੀਵਨ ਦੇ ਵਿੱਚ ਇੱਕ ਅਹਿਮ ਰੋਲ ਅਦਾ ਕਰਦੀਆਂ ਨੇ ਅਤੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਹਮੇਸ਼ਾ ਹੀ ਕਿਸੇ ਨਾ ਕਿਸੇ ਗੇਮ ਦੇ ਵਿੱਚ ਪਾਰਟੀਸਪੇਟ ਕਰਨ ਜੇਕਰ ਅੱਜਕੱਲ੍ਹ ਦੇ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਜ਼ਿਆਦਾਤਰ ਦਿਲਚਸਪੀ ਗੇਮਾਂ ਆਊਟਡੋਰ ਗੇਮ ਦੇ ਵਿੱਚ ਨਹੀਂ ਦਿਖਾਉਂਦੇ ਕਿਉਂਕਿ ਉਹਨਾਂ ਨੂੰ ਅੱਜਕੱਲ੍ਹ ਜਿਵੇਂ ਮੋਬਾਈਲ ਦੇ ਵਿੱਚ ਗੇਮਸ ਆ ਗਈਆਂ ਨੇ ਪਬਜ਼ੀ ਹੋ ਗਈ ਇੱਦਾਂ ਦੀਆਂ ਗੇਮਸ ਜਿਹੜੀਆਂ ਕਿ ਮੋਬਾਈਲ ਦੇ ਵਿੱਚ ਖੇਡੀਆਂ ਜਾਂਦੀਆਂ ਨੇ ਉਹਨਾਂ ਨੂੰ ਉਹੀ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਨੇ ਜਦਕਿ ਉਹ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਨੇ ਉਹਦੇ ਨਾਲ ਕੀ ਹੈ ਸਾਡਾ ਜਿਹੜਾ ਬਰੇਨ ਹੈ ਉਹ ਸੁਸਤ ਹੋਣ ਲੱਗ ਜਾਂਦਾ ਹੈ ਜੇਕਰ ਅੱਜਕੱਲ੍ਹ ਮਾਂ ਬਾਪ ਨੂੰ ਵੀ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਹਮੇਸ਼ਾ ਹੀ ਬੱਚਿਆਂ ਨੂੰ ਗਾਈਡ ਕਰਨਾ ਚਾਹੀਦਾ ਹੈ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਕੀ ਉਹ ਬਾਹਰ ਜਾ ਕੇ ਆਪਣੇ ਬੱਚਿਆਂ ਦੇ ਨਾਲ ਖੇਡਣ ਜਾਂ ਉਹਨਾਂ ਨੂੰ ਪ ਮੋਟੀਵੇਟ ਕਰਨ ਕਿ ਉਹ ਆਊਟਡੋਰ ਗੇਮਸ ਦੇ ਵਿੱਚ ਪਾਰਟੀਸਪੇਟ ਕਰਨ ਤਾਂ ਜੋ ਉਹ ਤੰਦਰੁਸਤ ਰਹਿਣ ਅਤੇ ਉਹਨਾਂ ਦੇ ਵਿੱਚ ਉਹ ਫੁਰਤੀ ਜਿਹੜੀ ਕਿ ਸਾਡੇ ਬਜ਼ੁਰਗਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੁੰਦੀ ਸੀ ਉਹ ਉਹਨਾਂ ਬੱਚਿਆਂ ਦੇ ਵਿੱਚ ਵੀ ਡਿਵੈਲਪ ਹੋ ਸਕੇ ਉਹ ਤਾਂ ਹੀ ਹੋ ਸਕਦੀ ਹੈ ਅਗਰ ਬੱਚੇ ਗੇਮਸ ਦੇ ਵਿੱਚ ਪਾਰਟੀਸਪੇਟ ਕਰਨਗੇ